ਹੈਲੋ ਹਾਂਜੀ ਹਾਂਜੀ ਬੋਲ ਰਿਹਾਂ ਜੀ ਅੱਛਾ ਅੱਛਾ ਅੱਛਾ ਕਦੋਂ ਆਉਣਾ ਜੀ ਅੱਛਾ ਅੱਛਾ ਅੱਛਾ ਕਿੱਥੋਂ ਆਉਣਾ ਤੁਸੀਂ ਅੱਛਾ ਅੱਛਾ ਅੱਛਾ ਦੇਖੋ ਵੈਸੇ ਤਾਂ ਟ੍ਰੇਨ ਵੀ ਆਉਂਦੀ ਹੈ ਫਤਹਿਗੜ੍ਹ ਸਾਹਿਬ ਤੱਕ ਟ੍ਰੇਨ ਉਦੇ ਆਪਾਂ ਨੂੰ ਇੱਥੋਂ ਚੇਂਜ ਕਰਨਾ ਪੈਣਾ ਅਦਰਵਾਇਸ ਫਿਰ ਸਾਡੇ ਕੋਲ ਗੱਡੀ ਵੀ ਹੈਗੀ ਸਾਡਾ ਮੁੰਡਾ ਹੈਗਾ ਇੱਕ ਬਿੱਟੂ ਅਤੇ ਉਹ ਪੂਰਾ ਗੁਰਸਿੱਖ ਬੰਦਾ ਉਹ ਤੁਹਾਨੂੰ ਘੁੰਮਾ ਘਮੂ ਦੇਊਗਾ ਹਾਂ ਖਰਚਾ ਕੁਛ ਜ਼ਿਆਦਾ ਨਹੀਂ ਹੋਣਾ ਖਰਚਾ ਬੱਸ ਆਹੀ ਤੁਸੀਂ ਪੰਜ ਸੱਤ ਹਜ਼ਾਰ ਮੰਨ ਕੇ ਚੱਲੋ ਅਤੇ ਤੁਹਾਨੂੰ ਵਧੀਆ ਘੁਮਾਦਾਂਗੇ ਉੱਥੇ ਨਾਲ ਨਾਲ ਹੋਰ ਵੀ ਜਗ੍ਹਾ ਦਿਖਾਦਾਂਗੇ ਕੋਈ ਨਹੀਂ ਸਰ ਦੇਖ ਲਵਾਂਗੇ ਟੈਮ 'ਤੇ ਹਾਂਜੀ ਹਾਂ ਕਿੰਨੇ ਦਿਨ ਲਈ ਆਉਣਾ ਹੈ ਅੱਛਾ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਓਕੇ ਠੀਕ ਹੈ